ਕੁਆਲਟੀ ਚੌਂਕ ਪ੍ਰਤਾਪ ਚੌਂਕ ਗਿੱਲ ਚੌਂਕ ਲੇਬਰ ਚੌਂਕ ਏ ਟੀ ਆਈ ਰੋਡ ਬੀ ਆਰ ਐੱਸ ਨਗਰ ਬੱਤੀ ਸੈਕਟਰ ਸਮਰਾਲਾ ਚੌਂਕ ਜਮਾਲਪੁਰ ਮੋਡਲ ਟਾਊਨ ਆਰਤੀ ਚੌਂਕ ਢੋਲੇਵਾਲ ਚੌਂਕ ਗਿੱਲ ਚੌਂਕ